ਸਾਡੇ ਖੇਤਰ ਵਿੱਚ ਦਸਵੀਂ ਜਮਾਤ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਦੀਆਂ ਤਰਜੀਹਾਂ ਬੀਕੌਮ ਕਰਨ ਵਿੱਚ ਹੈ ਕਿਉਂਕਿ ਅੱਜ ਕੱਲ੍ਹ ਦੇ ਜਮਾਨੇ ਵਿੱਚ ਕੰਪਨੀਆਂ ਵਿੱਚ ਅਕਾਊਂਟੈਂਟ ਬਹੁਤ ਹੀ ਹੋ ਗਏ ਹਨ ਇਸ ਕਰਕੇ ਜ਼ਿਆਦਾਤਰ ਦਸਵੀਂ ਤੋਂ ਬਾਅਦ ਵਿਦਿਆਰਥੀਆਂ ਦੀ ਤਰਜੀਹਾਂ ਪਲੱਸ ਵਨ ਪਲੱਸ ਟੂ ਵਿੱਚ ਕਮਰਸ ਰੱਖਣ ਦੀ ਹੀ ਹੁੰਦੀ ਹੈ ਉਹਨਾਂ ਦੀ ਜ਼ਿਆਦਾਤਰ ਸੋਚ ਇਹ ਹੀ ਹੁੰਦੀ ਹੈ ਕਿ ਸਭ ਤੋਂ ਵੱਧ ਜ਼ਿਆਦਾ ਫਾਇਦਾ ਉੱਥੇ ਹੀ ਹੁੰਦਾ ਹੈ ਧੰਨਵਾਦ